ਅੱਜ ਕੱਲ ਬਹੁਤ ਲੋਕ ਅਲੱਗ ਅਲੱਗ ਤਰੀਕਿਆਂ ਦੇ ਨਿਊਜ਼ ਸੁਣਦੇ ਆ ਜਿਵੇਂ ਕਿ ਉਹਨਾਂ ਦਾ ਫਰੀ ਸਮੇਂ ਵਿੱਚ ਉਹ ਨਿਊਜ਼ ਟੀ ਵੀ ਤੋਂ ਦੇਖ ਸਕਦੇ ਆ ਮੋਬਾਈਲ ਤੋਂ ਜਾਂ ਰੇਡੂਏ ਤੋਂ ਦੇਖ ਕੇ ਉਹਨਾਂ ਨੂੰ ਬਹੁਤ ਨਵੀਂ ਨਵੀਂ ਚੀਜ਼ਾਂ ਮਿਲ ਸਕਦੀਆਂ ਪਰ ਇਸ ਕੁਸ਼ਚਨ ਦਾ ਮੇਨ ਵਿਸ਼ੇ ਆਹ ਹੈ ਕਿ ਕੀ ਮੋਬਾਇਲ ਫੋਨਾਂ 'ਤੇ ਜਾਂ ਟੈਕਨੋਲੋਜੀ ਦੇ ਜਿਹੜੀ ਖਬਰ ਹੁੰਦੀ ਹੈ ਉਹ ਸਹੀ ਦਿੱਤੀ ਜਾਂਦੀ ਆ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਇਹ ਖਬਰ ਸਹੀ ਦਿੱਤੀ ਜਾਂਦੀ ਹੈ ਕਿਉਂਕਿ ਜੇ ਉਹ ਗਲਤ ਦਊਗੇ ਤਾਂ ਉਹਨਾਂ ਦਾ ਹੀ ਨੁਕਸਾਨ ਹੋਊਗਾ ਜੇ ਉਹ ਗਲਤ ਖਬਰ ਦਊਗੇ ਉਹਨਾਂ ਦੀ ਵਿਊਅਰ ਸਬਸਕ੍ਰਿਪਸ਼ਨ ਘਟੇਗੀ ਫਿਰ ਘੱਟ ਲੋਕ ਉਹਨਾਂ ਨੂੰ ਦੇਖੂਗੇ ਅਤੇ ਉਹਦੇ ਕਾਰਨ ਉਹਨਾਂ ਦੇ ਮਨੀ 'ਤੇ ਵੀ ਇਫੈਕਟ ਪਊਗਾ ਜ਼ਿਆਦਾ ਪੈਸੇ ਨਹੀਂ ਕਮਾ ਸਕਦੇ ਅਤੇ ਦੂਜਾ ਰੀਜਨ ਇਹ ਆ ਕਿ ਅੱਜ ਕੱਲ੍ਹ ਸਾਰਿਆਂ ਨੂੰ ਆਪਣੀ ਰੈਪੋਟੀਸ਼ਨ ਪਿਆਰੀ ਹੁੰਦੀ ਆ ਜੇ ਉਹ ਹਮੇਸ਼ਾ ਵਧੀਆ ਖਬਰ ਦਊਗੇ ਤਾਂ ਬਹੁਤ ਲੋਕਾਂ ਬਾਰੇ ਉਹਨਾਂ ਨੂੰ ਬਹੁਤ ਲੋਕਾਂ ਤੋਂ ਉਹਨਾਂ ਨੂੰ ਪ੍ਰਸ਼ੰਸਾ ਮਿਲੇਗੀ ਅਤੇ ਉਹਨਾਂ ਦੀ ਵਧੀਆ ਰੈਪੂਟੇਸ਼ਨ ਬਣੀ ਰਹੇਗੀ ਅਤੇ ਅੱਜ ਕੱਲ੍ਹ ਗੌਰਮੈਂਟ ਨੇ ਵੀ ਇਹ ਰੂਲ ਕੀਤਾ ਹੈ ਜੇ ਕੋਈ ਸਰਕਾਰ ਲੋਕਾਂ ਨੂੰ ਗਲਤ ਰਾਹ 'ਤੇ ਤੋੜੂ ਤੋਰੇਗਾ ਉਹਨਾਂ ਨੂੰ ਸਜ਼ਾ ਮਿਲੇਗੀ ਅਤੇ ਇਸ ਕਰਕੇ ਸਾਰੇ ਲੋਕ ਸਹੀ ਖਬਰਾਂ ਦੇਣਾ ਪਸੰਦ ਕਰ ਅ ਪਸੰਦ ਕਰਦੇ ਆ ਟੀ ਵੀ ਨਿਊਜ਼ ਵਾਲੇ ਕਿਉਂਕਿ ਸਹੀ ਖਬਰਾਂ ਦੇ ਕੇ ਉਹ ਵਧੀਆ ਫੇਮ ਲੈ ਸਕਦੇ ਆ ਅਤੇ ਇਹਦੇ ਨਾਲ ਉਹ ਆਪਣੇ ਫੈਮਲੀ ਨੂੰ ਹੋਰ ਅਪਗਰੇਡ ਕਰ ਸਕਦੇ ਆ ਉਹਨਾਂ ਦੀ ਸਬਸਕ੍ਰਿਪਸ਼ਨ ਵੀ ਵਧੇਗੀ ਅਤੇ ਉਹਨਾਂ ਦੇ ਵਿਊ ਵੀ ਆਉਗੇ ਜ਼ਿਆਦਾਤਰ ਅੱਜ ਕੱਲ ਕੁਛ ਕੁ ਹੀ ਚੈਨਲ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ ਪੈਸਾ ਮਿਲਦਾ ਝੂਠ ਬੋਲਣ ਲਈ ਪਰ ਜ਼ਿਆਦਾਤਰ ਅੱਜ ਕੱਲ੍ਹ ਚੈਨਲ ਪੰਜਾਬ ਵੱਲ ਹੋ ਗਏ ਨੇ ਤਾਂ ਕਰਕੇ ਉਹ ਹਮੇਸ਼ਾ ਸੱਚ ਬੋਲਦੇ ਆ ਅਤੇ ਸਾਰੇ ਲੋਕਾਂ ਨੂੰ ਸਹੀ ਰਾਹ 'ਤੇ ਤੁਰਨ ਨੂੰ ਪਾਉਂਦੇ ਆ ਜਿਹਦੇ ਕਰਕੇ ਉਹ ਆਪਣੇ ਦੇਸ਼ ਨੂੰ ਅੱਗੇ ਵਧਣਾ ਦੇਖਣਾ ਚਾਹੁੰਦੇ ਆ ਤਾਂ ਕਰਕੇ ਉਹ ਹਮੇਸ਼ਾ ਸਰਕਾਰ ਨੂੰ ਸਹੀ ਖ ਸਾਰੇ ਲੋਕਾਂ ਨੂੰ ਸਹੀ ਖਬਰਾਂ ਦਊਗੇ